ਪੰਜਾਬ ਵਿੱਚ ਬਹੁਤ ਸਾਰੇ ਧਰਮ ਹਨ ਜਿਵੇਂ ਕਿ ਕੁਰਾਨ ਬਾਈਬਲ ਵੇਦ ਬਟ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਿਵਾਉਂਦੇ ਹਾਂ ਅਸੀਂ ਕੋਈ ਵੀ ਘਰ ਦਾ ਕਾਰਜ ਕੋਈ ਵੀ ਘਰ ਦਾ ਕਾਰਜ ਕਰਨਾ ਹੋਵੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀ ਉਹਨਾਂ ਅੱਗੇ ਅਰਦਾਸ ਕਰਕੇ ਫਿਰ ਕਰੀਦਾ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਜੀ ਜੀ ਕੋਲੋਂ ਸਾਨੂੰ ਬਹੁਤ ਸਾਰਾ ਗਿਆਨ ਮਿਲਦਾ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਬਹੁਤ ਜ਼ਿਆਦਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਉਹਨਾਂ ਤੋਂ ਉਹਨਾਂ ਅੱਗੇ ਅਸੀਂ ਸੀਸ ਨਿਵਾਉਂਦੇ ਹਾਂ ਸਵੇਰੇ ਸਲੋਕ ਸਾਹਿਬ ਕਰਕੇ ਸਲੋਕ ਸਾਹਿਬ ਦਾ ਪਾਠ ਕਰਕੇ ਸ਼ਾਮੀ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਾਨੂੰ ਬਹੁਤ ਕੁਝ ਬਹੁਤ ਕੁਝ ਮਿਲਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਹਨਾਂ ਦੇ ਉਹਨਾਂ ਦੇ ਰਾਹ ਉੱਤੇ ਤੁਰਨਾ ਵੀ ਪੈਂਦਾ ਹੈ ਜੋ ਸਾਨੂੰ ਮਿਲਦਾ ਹੈ ਸਿਰ ਮੱਥੇ